ਨਹੀਂ ਮੈਂ ਚਿੱਤਰਕਾਰੀ ਦੀ ਕੋਈ ਵੀ ਅਲੱਗ ਤੋਂ ਕਲਾਸ ਜਾਂ ਫਿਰ ਵਰਕਸ਼ਾਪ ਨਹੀਂ ਲਗਾਈ ਅਸੀਂ ਜਦੋਂ ਸਕੂਲ ਜਾਂਦੇ ਸੀ ਤਾਂ ਸਾਡੇ ਛੋਟੇ ਹੁੰਦਿਆਂ ਤੋਂ ਇੱਕ ਸਬਜੈਕਟ ਹੁੰਦਾ ਸੀਗਾ ਡਰਾਇੰਗ ਦਾ ਉੱਥੇ ਕਲਾਸ ਦੇ ਵਿੱਚ ਕੀ ਸੀਗਾ ਸਕੂਲ ਦੇ ਵਿੱਚ ਕੀ ਸੀਗਾ ਕਿ ਸਾਡੇ ਜੋ ਟੀਚਰ ਸੀਗੇ ਉਹ ਸਾਨੂੰ ਨਿੱਕੇ ਨਿੱਕੇ ਮਤਲਬ ਕਿ ਜਿਵੇਂ ਫਲਾਰਸ ਹੋ ਗਏ ਹੱਟ ਹੋ ਗਈ ਇੱਦਾਂ ਇੱਦਾਂ ਦੀਆਂ ਡਰੋਇੰਗ ਕਰਵਾਉਂਦੇ ਸੀਗੇ ਸਟਾਰਟਿੰਗ ਮੈਂ ਉੱਥੋਂ ਕੀਤੀ ਉੱਥੋਂ ਕੀ ਸੀਗਾ ਕੀ ਉਹ ਸਾਨੂੰ ਨਿੱਕੀ ਨਿੱਕੀ ਚੀਜ਼ ਡਰੋਇੰਗ ਦੇ ਪ੍ਰੈਕਟਿਸ ਕਰਵਾਉਂਦੇ ਸੀਗੇ ਸਕੂਲ ਦੇ ਵਿੱਚ ਹੀ ਹਰ ਇੱਕ ਹਰ ਰੋਜ਼ ਇੱਕ ਲੈਕਚਰ ਹੁੰਦਾ ਸੀਗਾ ਡਰੋਇੰਗ ਦਾ ਅਤੇ ਫਿਰ ਉੱਥੋਂ ਉੱਥੋਂ ਮੈਂ ਜਿਹੜੀ ਸੀਗੀ ਡਰੋਇੰਗ ਸ਼ੁਰੂ ਕੀਤੀ ਫਿਰ ਸਾਨੂੰ ਫਿਫਥ ਕਲਾਸ ਤੱਕ ਜਿਹੜਾ ਸੀਗਾ ਉਹ ਡਰਾਇੰਗ ਡਰੋਇੰਗ ਸਿਖਾਈ ਫਿਫਥ ਤੱਕ ਫਿਫਥ ਕਲਾਸ ਤੱਕ ਮੈਂ ਇਸੀ ਸਕੂਲ ਦੀ ਕਲਾਸ ਦੇ ਵਿੱਚ ਜਿਹੜੀ ਸੀ ਉਹ ਡਰੋਇੰਗ ਸਿੱਖੀ ਇਸ ਤੋਂ ਬਾਅਦ ਜਿਹੜੀ ਡਰੋਇੰਗ ਸਬਜੈਕਟ ਆ ਉਹ ਸਾਨੂੰ ਨਹੀਂ ਰਿਹਾ ਅਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਘਰੇ ਹੀ ਜਿਹੜੀ ਆ ਉਹ ਡਰੋਇੰਗ ਕਰਨੀ ਸ਼ੁਰੂ ਕੀਤੀ ਜਿਹੜਾ ਬੇਸਿਕ ਸੀਗਾ ਡਰੋਇੰਗ ਦਾ ਜਾਂ ਜੋ ਬੇਸ ਸੀਗਾ ਉਹ ਮੇਰਾ ਸਕੂਲ ਜਾਂਦਿਆਂ ਹੀ ਉੱਥੇ ਹੀ ਬਣ ਗਿਆ ਸੀਗਾ ਫਿਰ ਜਦੋਂ ਸਕੂਲ ਤੋਂ ਮਤਲਬ ਕੀ ਡਰੋਇੰਗ ਬੰਦ ਹੋ ਗਈ ਅਤੇ ਫਿਰ ਅਸੀਂ ਜਦੋਂ ਘਰੇ ਸ਼ੁਰੂ ਕੀਤੀ ਤਾਂ ਫਿਰ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਸੀ ਉਹ ਡਰੋਇੰਗ ਕਰਨੀ ਆ ਗਈ ਮੈਂ ਇਸ ਦੀ ਅਲੱਗ ਤੋਂ ਕੋਈ ਵੀ ਵਰਕਸ਼ਾਪ ਜਾਂ ਫਿਰ ਕਲਾਸ ਨਹੀਂ ਲਗਾਈ ਅਤੇ ਮੇਰਾ ਅਨੁਭਵ ਉੱਥੇ ਇਹੀ ਰਿਹਾ ਕਿ ਜੋ ਵੀ ਅਸੀਂ ਸਿੱਖਿਆ ਸੀਗਾ ਉਹ ਸਕੂਲ ਦੇ ਵਿੱਚ ਹੀ ਸੀਗਾ ਜੋ ਮੈਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕੀ ਕਦੀ ਕੋਈ ਫਲਾਰ ਬਣਾਉਣਾ ਦੇ ਦਿੱਤਾ ਕਦੀ ਹਟ ਬਣਾਉਣੀ ਦੇ ਦਿੱਤੀ ਇੱਦਾਂ ਇੱਦਾਂ ਦੀਆਂ ਡਰੋਇੰਗਸ ਜਿਹੜੀਆਂ ਸੀਗੀਆਂ ਉਹ ਅਸੀਂ ਸਟਾਰਟ ਕੀਤੀਆਂ ਸੀਗੀਆਂ ਫਿਰ ਇਸ ਤੋਂ ਬਾਅਦ ਹੁਣ ਜੋ ਵੀ ਡਰੋਇੰਗ ਮੈਂ ਕਰਦੀ ਉਹ ਮੈਂ ਆਪਣੇ ਆਪ ਹੀ ਕਰਦੀ ਹਾਂ ਕੋਈ ਵੀ ਜਿਹੜੀ ਫੋਟੋ ਮੈਂ ਜਿਹੜੀ ਮਰਜ਼ੀ ਉਹਨੂੰ ਵੇਖ ਕੇ ਉਹੋ ਜਿਹਾ ਹੀ ਸੇਮ ਜਿਹੜਾ ਉਹ ਬਣਾ ਲੈਂਦੀ ਹਾਂ ਇਸ ਤਰੀਕੇ ਨਾਲ ਜਿਹੜੀ ਡਰੋਇੰਗ ਆ ਉਹ ਜਿਹੜੀ ਮੈਂ ਸਟਾਰਟ ਕੀਤੀ ਸੀਗੀ ਸਕੂਲ ਦੀਆਂ ਕਲਾਸਿਜ਼ ਤੋਂ ਕੋਈ ਅਲੱਗ ਤੋਂ ਜਿਹੜੀ ਕਲਾਸ ਯਾਂ ਫਿਰ ਜਿਹੜੀ ਵਰਕਸ਼ਾਪ ਮੈਂ ਨਹੀਂ ਲਗਾਈ ਸੀਗੀ